ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਪਹਿਲੀ ਗੱਲ ਤਾਂ ਜੀ ਤੁਹਾਡਾ ਬਠਿੰਡੇ ਦੇ ਵਿੱਚ ਬਹੁਤ ਬਹੁਤ ਸਵਾਗਤ ਆ ਅਤੇ ਕੋਈ ਹਾਂਜੀ ਕੋਈ ਗੱਲ ਨਹੀਂ ਅਸੀਂ ਬੈਠੇ ਹਾਂ ਤੁਹਾਨੂੰ ਬਠਿੰਡਾ ਸ਼ਹਿਰ ਘੁੰਮਾਉਣ ਵਾਸਤੇ ਅਤੇ ਤੁਸੀਂ ਇਹ ਕਦੋਂ ਵਿਜਿਟ ਕਰ ਰਹੇ ਹੋ ਮੈਡਮ ਠੀਕ ਹੈ ਮੈਮ ਤੁਹਾਡੇ ਕੋਲ ਨੰਬਰ ਤਾਂ ਮੇਰਾ ਆ ਹੀ ਗਿਆ ਤੁਸੀਂ ਮੈਨੂੰ ਕਾਲ ਕਰ ਦੇਣਾ ਅਤੇ ਜਗ੍ਹਾਵਾਂ ਹੈਗੀਆਂ ਜੀ ਬਠਿੰਡੇ ਦੇ ਵਿੱਚ ਘੁੰਮਣ ਵਾਸਤੇ ਜਿਹੜੀ ਸਭ ਤੋਂ ਫੇਮਸ ਜਗ੍ਹਾ ਮੰਨੀ ਜਾਂਦੀ ਹੈ ਉਹ ਹੈਗੀ ਜੀ ਕਿਲ੍ਹਾ ਮੁਬਾਰਕ ਬੱਸ ਸਟੈਂਡ ਤੋਂ ਥੋੜ੍ਹੀ ਦੂਰ ਆ ਆਪਾਂ ਆਟੋ ਵੀ ਲੈ ਸਕਦੇ ਹਾਂ ਅਤੇ ਆਪਾਂ ਪੈਦਲ ਵੀ ਜਾ ਸਕਦੇ ਆ ਕੋਈ ਬਹੁਤਾ ਜ਼ਿਆਦਾ ਦੂਰ ਨਹੀਂ ਜੇ ਪੈਦਲ ਗਏ ਤਾਂ ਇਹਦਾ ਇਹ ਫ਼ਾਇਦਾ ਹੋਊਗਾ ਕਿ ਰਸਤੇ ਦੇ ਵਿੱਚ ਜਿਹੜੀ ਮਾਰਕੀਟ ਪੈਂਦੀ ਹੈਗੀ ਤੁਸੀਂ ਉਹਨੂੰ ਵੀ ਚੰਗੀ ਤਰ੍ਹਾਂ ਦੇਖ ਸਕਦੇ ਆ ਅਤੇ ਜਿਹੜਾ ਹਾਂ ਅਫੋਰਡੇਬਲ ਪ੍ਰਾਈਜ 'ਤੇ ਤੁਹਾਨੂੰ ਬਹੁਤ ਚੰਗੀਆਂ ਚੰਗੀਆਂ ਚੀਜ਼ਾਂ ਪੰਜਾਬ ਦੀ ਜਿਹੜੀ ਸੱਭਿਆਚਾਰ ਨਾਲ ਰਿਲੇਟਡ ਤੁਹਾਨੂੰ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਮਿਲਣਗੀਆਂ ਅਤੇ ਦੂਸਰਾ ਨੰਬਰ ਤੁਸੀਂ ਦੇਖ ਸਕਦੇ ਹੋ ਜੀ ਰੋਜ਼ ਗਾਰਡਨ ਆ ਉਹ ਵੀ ਬੱਸ ਸਟੈਂਡ ਤੋਂ ਥੋੜ੍ਹੀ ਦੂਰੀ 'ਤੇ ਆ ਅਤੇ ਆਪਾਂ ਬਾਏ ਆਟੋ 'ਤੇ ਜਾ ਸਕਦੇ ਹਾਂ ਉੱਥੇ ਵੀ ਅਤੇ ਹਾਂਜੀ ਅਤੇ ਬਠਿੰਡੇ ਦਾ ਜਿਹੜਾ ਇੱਕ ਵੀ ਸਭ ਤੋਂ ਮਸ਼ਹੂਰ ਮੋਲ ਵੱਜਦਾ ਗਾ ਮਿੱਤਲ ਮੋਲ ਤੁਸੀਂ ਉਹ ਵੀ ਦੇਖ ਸਕਦੇ ਹੋ ਅਤੇ ਤੁਹਾਨੂੰ ਬੜਾ ਚੰਗਾ ਲੱਗੂਗਾ ਅਤੇ ਇਹਦੇ ਤੋਂ ਹਾਂਜੀ ਅਤੇ ਇਹਦੇ ਤੋਂ ਇਲਾਵਾ ਤੁਸੀਂ ਝੀਲਾਂ ਦੇਖ ਸਕਦੇ ਹੋ ਜਿਹੜੀਆਂ ਸਭ ਤੋਂ ਮਸ਼ਹੂਰ ਹਾਂਜੀ ਜਗ੍ਹਾ ਹੈਗੀ ਹੈ ਤੁਸੀਂ ਉੱਥੇ ਵੋਟਿੰਗ ਵੀ ਕਰ ਸਕਦੇ ਹੋ ਤੁਹਾਨੂੰ ਸ ਵਧੀਆ ਸਭ ਕੁਝ ਚੰਗੀ ਸਹੂਲਤਾਂ ਮਿਲਣਗੀਆਂ ਉੱਥੇ ਅਤੇ ਇਹਦੇ ਸਾਰਿਆਂ ਸਾਰੇ ਪਲੈਨਾਂ ਵਾਸਤੇ ਤੁਹਾਨੂੰ ਹਮੇਸ਼ਾ ਜਿਹੜੇ ਆਟੋ ਅਵੇਲੇਬਲ ਮਿਲ ਜਾਣਗੇ ਅਤੇ ਹਾਂਜੀ ਉਹ ਤੁਹਾਨੂੰ ਬੱਸ ਸਟੈਂਡ ਤੋਂ ਹੀ ਮਿਲ ਜਾਣਗੇ ਕਿ ਇਸ ਤੋਂ ਇਲਾਵਾ ਤੁਸੀਂ ਬਠਿੰਡੇ ਦੇ ਵਿੱਚ ਹੀ ਜੇ ਕੋਈ ਵਿੱਦਿਅਕ ਸੰਸਾ ਸੰਸਥਾ ਵੇਖਣੀ ਆ ਤਾਂ ਤੁਸੀਂ ਬਾ ਬਾਦਲ ਰੋ ਰੋਡ ਦੇ ਉੱਤੇ ਆਪਣੀ ਹੈਗੀ ਆ ਮਹਾਰਾਜਾ ਰਣਜੀਤ ਸਿੰਘ ਪੋਲੀਟੈਕਨੀਕ ਯੂਨੀਵਰਸਿਟੀ ਬਣੀ ਹੋਈ ਹੈਗੀ ਜਿਹੜੀ ਹਾਂਜੀ ਪੰਜਾਬੀ ਸੱਭਿਆਚਾਰ ਨੂੰ ਰੀਪ੍ਰਜੈਂਟ ਕਰਦੀ ਹੈਗੀ ਤੁਸੀਂ ਉਹ ਯੂਨੀਵਰਸਿਟੀ ਵੀ ਦੇਖ ਸਕਦੇ ਹੋ ਅਤੇ ਬਠਿੰਡੇ ਤੋਂ ਬਾਈ ਕਿਲੋਮੀਟਰ ਅੱਗੇ ਸੈਂਟਰ ਦੀ ਯੂਨੀਵਰਸਿਟੀ ਬਣੀ ਹੋਈ ਹੈ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਤੁਸੀਂ ਇੱਥੇ ਵੀ ਵਿਜਿਟ ਕਰ ਸਕਦੇ ਹੋ ਧਾਰਮਿਕ ਸਥਾਨ ਇੱਕ ਤਾਂ ਜੀ ਕਿਲ੍ਹਾ ਮੁਬਾਰਕ ਵੀ ਆਪਣਾ ਧਾਰਮਿਕ ਸਥਾਨ ਹੈ ਇਸ ਤੋਂ ਇਲਾਵਾ ਸਾਬੋ ਤਲਵੰਡੀ ਆ ਬਠਿੰਡੇ ਤੋਂ ਥੋੜ੍ਹੀ ਦੂਰ 'ਤੇ ਉੱਥੇ ਸ੍ਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਜਾਨੀ ਕਿ ਅਤੇ ਉੱਥੇ ਵੀ ਤੁਸੀਂ ਵਿਜਿਟ ਕਰ ਸਕਦੇ ਹੋ ਦਮਦਮਾ ਸਾਹਿਬ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਸਾਬੋ ਤਲਵੰਡੀ ਤੁਸੀਂ ਉੱਥੇ ਵੀ ਵਿਜਿਟ ਕਰ ਸਕਦੇ ਹੋ ਅਤੇ ਬਾਕੀ ਕੋਈ ਗੱਲ ਨਹੀਂ ਜਦੋਂ ਤੁਸੀਂ ਕੱਲ੍ਹ ਬਠਿੰਡੇ ਪਹੁੰਚਦੇ ਹੋ ਤੁਸੀਂ ਮੈਨੂੰ ਫੋਨ ਕਰ ਲੈਣਾ ਅਤੇ ਅਸੀਂ ਤੁਹਾਨੂੰ ਚੰਗੀ ਚੰਗੀ ਤੋਂ ਚੰਗੀ ਤਰ੍ਹਾਂ ਗਾਈਡ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਤੁਹਾਡਾ ਬਠਿੰਡੇ ਦੇ ਵਿੱਚ ਫਿਰ ਤੋਂ ਬਹੁਤ ਬਹੁਤ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਆ ਹਾਂਜੀ ਠੀਕ ਹੈ ਮੈਡਮ ਜੀ